ਸਾਡੀ ਸਥਾਨਕ ਭਾਸ਼ਾ ਪੰਜਾਬੀ ਹੈ ਅਤੇ ਇਸ ਵਿੱਚ ਬਹੁਤ ਸਾਰੇ ਯੂਟੀਊਬ ਚੈਨਲ ਬਣੇ ਹੋਏ ਹਨ ਇਹਨਾਂ ਸਭ ਵਿੱਚੋਂ ਮੇਰਾ ਮਨ ਪਸੰਦੀਦਾ ਚੈਨਲ ਬੀਰ ਰਾਮਗੜੀਆਂ ਹੈ ਮੈਨੂੰ ਬੀਰ ਰਾਮਗੜੀਆਂ ਦਾ ਚੈਨਲ ਦੇਖਣਾ ਬਹੁਤ ਪਸੰਦ ਹੈ ਮੈਂ ਇਸਦੀ ਕੋਈ ਵੀ ਅਜਿਹੀ ਵੀਡੀਓ ਨਹੀਂ ਜਿਹੜੀ ਕਿ ਦੇਖੀ ਨਹੀਂ ਹੋਵੇਗੀ ਬੀਰ ਰਾਮਗੜੀਆਂ ਨੂੰ ਉਂ ਮੈਂ ਤਾਂ ਦੇਖਣਾ ਪਸੰਦ ਕਰਦਾ ਹਾਂ ਕਿਉਂਕਿ ਇਸਦਾ ਕੋਂਟੈਂਟ ਬਹੁਤ ਵਧੀਆ ਹੁੰਦਾ ਹੈ ਅਤੇ ਇਸ ਤੋਂ ਸਾਨੂੰ ਸਿੱਖਣ ਨੂੰ ਮਿਲਦਾ ਹੈ ਇਹ ਅਲੱਗ ਅਲੱਗ ਦੇਸ਼ਾਂ ਵਿੱਚ ਯਾਤਰਾ ਕਰਦਾ ਹੈ ਅਤੇ ਸਾਨੂੰ ਉੱਥੋਂ ਦੇ ਰਹਿਣ ਸਹਿਣ ਖਾਣ ਪੀਣ ਬੋਲ ਚਾਲ ਪਹਿਰਾਵੇ ਅਤੇ ਆਵਾਜਾਈ ਦੇ ਸਾਧਨਾਂ ਬਾਰੇ ਦੱਸਦਾ ਹੈ ਇਹ ਦੱਸਦਾ ਹੈ ਕਿ ਉੱਥੋਂ ਦੇ ਲੋਕ ਕਿਸ ਤਰ੍ਹਾਂ ਆਪਣਾ ਜੀਵਨ ਬਤੀਤ ਕਰਦੇ ਹਨ ਅਤੇ ਉਹਨਾਂ ਦੀ ਕਮਾਈ ਦਾ ਸਾਧਨ ਕੀ ਹੈ ਵੈਸੇ ਤਾਂ ਮੈਨੂੰ ਆਪਣੀ ਸਥਾਨਕ ਭਾਸ਼ਾ ਪੰਜਾਬੀ ਵਿੱਚ ਹੀ ਦੇਖਣਾ ਪਸੰਦ ਹੈ ਪ੍ਰੰਤੂ ਫਿਰ ਵੀ ਮੈਂ ਕਦੇ ਕਦੇ ਕਪਿਲ ਸ਼ਰਮਾ ਦਾ ਸ਼ੋਅ ਦੇਖਣਾ ਪਸੰਦ ਕਰਦਾ ਹਾਂ ਕਪਿਲ ਸ਼ਰਮਾ ਦਾ ਸ਼ੋਅ ਮੈਨੂੰ ਬਹੁਤ ਹੀ ਵਧੀਆ ਲੱਗਦਾ ਹੈ ਕਿਉਂਕਿ ਉਹ ਆਪਣੇ ਸ਼ੋਅ ਵਿੱਚ ਬਹੁਤ ਹਾਸੇ ਲਗਵਾਉਂਦਾ ਹੈ ਕਪਿਲ ਸ਼ਰਮਾ ਵੀ ਪੰਜਾਬ ਦਾ ਪੁੱਤ ਹੈ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਬੋਲੀਵੁੱਡ ਦੇ ਬਹੁਤ ਵੱਡੇ ਵੱਡੇ ਸਿਤਾਰੇ ਆਉਂਦੇ ਹਨ ਅਤੇ ਉਹ ਉਹਨਾਂ ਨਾਲ ਹਾਸਾ ਮਜਾਕ ਕਰਦਾ ਰਹਿੰਦਾ ਹੈ ਅਤੇ ਬੋਲੀਵੁੱਡ ਸਟਾਰ ਵੀ ਉਸ ਨੂੰ ਦੇਖ ਕੇ ਕਮੇਡੀ ਕਰਦੇ ਹਨ ਕਪਿਲ ਦਾ ਸ਼ੋਅ ਮੁੰਬਈ ਦੇ ਵਿੱਚ ਹੁੰਦਾ ਹੈ ਉਹ ਆਪਣੇ ਸ਼ੋਅ ਵਿੱਚ ਗਿਫਟ ਟੈਂਪਰ ਵੀ ਦਿੰਦਾ ਹੈ ਇਸਦੇ ਨਾਲ ਨਾਲ ਹੀ ਮੈਨੂੰ ਫੂਡ ਵਲੋਗਿੰਗ ਦੇਖਣਾ ਬਹੁਤ ਪਸੰਦ ਹੈ ਹੈਰੀ ਉੱਪਲ ਜੋ ਕਿ ਮੇਰਾ ਮਨ ਪਸੰਦੀਦਾ ਫੂਡ ਵਲੋਗਰ ਹੈ ਉਹ ਵੱਖ ਵੱਖ ਪ੍ਰਾਂਤਾ ਵਿੱਚ ਘੁੰਮਦਾ ਹੈ ਉੱਥੋਂ ਦੇ ਭੋਜਨਾਂ ਬਾਰੇ ਸਾਨੂੰ ਜਾਣਕਾਰੀ ਦਿੰਦਾ ਹੈ ਅਤੇ ਉੱਥੋਂ ਦੇ ਫੇਮਸ ਪਕਵਾਨ ਬਾਰੇ ਜਾਣਕਾਰੀ ਦਿੰਦਾ ਹੈ ਕਿ ਉਹ ਕਿਸ ਤਰ੍ਹਾਂ ਬਣਾਏ ਜਾਂਦੇ ਹਨ ਉੱਥੋਂ ਦਾ ਫੇਮਸ ਚੀਜ਼ ਕੀ ਹੈ ਅਤੇ ਉਹਨਾਂ ਨਾਲ ਉਹਨਾਂ ਲੋਕਾਂ ਨਾਲ ਗੱਲਾਂ ਬਾਤਾਂ ਕਰਦਾ ਹੈ ਕਿ ਉਹ ਕਿਸ ਤਰ੍ਹਾਂ ਬਣਾਉਂਦੇ ਹਨ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਸਾਨੂੰ ਨਵੀਆਂ ਨਵੀਆਂ ਚੀਜ਼ਾਂ ਬਣਾਉਣ ਬਾਰੇ ਦੱਸਦਾ ਹੈ ਕਿ ਉਹ ਕਿਸ ਤਰ੍ਹਾਂ ਚੀਜ਼ਾਂ ਬਣਦੀਆਂ ਹਨ